ਹਾਂ ਅਸੀਂ ਕਿਸੇ ਨੂੰ ਪੇਂਟਿੰਗ ਜਾਂ ਹੱਥ ਨਾਲ ਬਣੇ ਕਾਰਡ ਦਾ ਤੋਹਫਾ ਦਿੱਤਾ ਹੈ ਕਿਸੇ ਦੇ ਮਤਲਬ ਕਿ ਬਰਡੇ 'ਤੇ ਗਿਫਟ ਦਿੱਤਾ ਹੈ ਹੱਥ ਨਾਲ ਬਣਾ ਕੇ ਕਾਰਡ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਆਪਣੀਆਂ ਚੀਜ਼ਾਂ ਬਹੁਤ ਹੀ ਵਧੀਆ ਹੁੰਦੀਆਂ ਹਨ ਭਾਵਨਕ ਹੁੰਦੀਆਂ ਹਨ ਅਤੇ ਇਸ ਵਿੱਚ ਆਪਣੇ ਹੱਥ ਨਾਲ ਜੋ ਕਿ ਆਪਣੇ ਦਿਲ ਦੀਆਂ ਭਾਵਨਾਵਾਂ ਹੁੰਦੀਆਂ ਹਨ ਉਹਨਾਂ ਨੂੰ ਲਿਖਿਆ ਜਾਂਦਾ ਹੈ ਅਤੇ ਉਹਨੂੰ ਲਿਖ ਕੇ ਦੂਜੇ ਨੂੰ ਵੀ ਪੜ੍ਹਨ ਵਾਲੇ ਨੂੰ ਦੇਖਣ ਵਾਲੇ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਸਾਨੂੰ ਉਹਨਾਂ ਨੇ ਹੱਥ ਨਾਲ ਬਣਾ ਕੇ ਦਿੱਤੇ ਅਤੇ ਹੋਰ ਵੀ ਪਿਆਰ ਵੱਧਦਾ ਹੈ ਇਹ ਚੀਜ਼ਾਂ ਦਾ ਮੁੱਲ ਬਹੁਤ ਹੀ ਭਾਵਨਾਤਮਕ ਹੁੰਦਾ ਹੈ ਅਤੇ ਇਹ ਚੀਜ਼ਾਂ ਬਹੁਤ ਹੀ ਕੀਮਤੀ ਬਣ ਜਾਂਦੀਆਂ ਹਨ ਅਤੇ ਆਪਣੇ ਹੱਥ ਨਾਲ ਬਣਾਇਆ ਹੋਇਆ ਤੋਹਫਾ ਬਹੁਤ ਹੀ ਕੀਮਤੀ ਹੋ ਜਾਂਦਾ ਹੈ